ਦੌੜਨ ਦਾ ਸ਼ੌਂਕ ਸ ਅਸੀਂ ਜਦੋਂ ਪੜ੍ਹਦੇ ਸਨ ਸਾਡੇ ਸਕੂਲ 'ਚ ਦੌੜਾਂ ਦਾ ਟੂਰਨਾਮੈਂਟ ਹੁੰਦਾ ਸੀ ਜਿਸ ਕਰਕੇ ਅਸੀਂ ਵੀ ਉਸ 'ਚ ਹਿੱਸਾ ਲੈਂਦੇ ਸਨ ਸਾਡੇ ਪੀ ਟੀ ਟੀਚਰ ਸਾਨੂੰ ਦੌੜ ਲਗਵਾਉਂਦੇ ਸਨ ਜਿਸ ਕਰਕੇ ਅਸੀਂ ਬਾਹਰ ਸਕੂਲਾਂ 'ਚ ਵੀ ਦੌੜਨ ਲਈ ਜਾਇਆ ਕਰਦੇ ਸਨ ਇਸ ਕਰਕੇ ਸਾਨੂੰ ਬਹੁਤ ਸ਼ੌਂਕ ਸੀ ਦੌੜਨ ਦਾ ਦੌੜਾਂ 'ਚ ਅਸੀਂ ਕਿਸੇ ਸਕੂਲ ਦੇ ਲਈ ਅਸੀਂ ਮੈਡਲ ਵੀ ਲੈ ਕੇ ਆਏ ਆਏ ਹਨ ਅਤੇ ਸਕੂਲਾਂ ਦਾ ਸਕੂਲਾਂ ਦਾ ਨਾਮ ਰੋਸ਼ਨ ਕੀਤਾ ਹੈ ਦੌੜਨ ਦੇ ਨਾਲ ਸਾਡੀ ਸਿਹਤ ਸਹੀ ਰਹਿੰਦੀ ਹੈ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਸਾਨੂੰ ਕੋਈ ਬੀਮਾਰੀ ਨਹੀਂ ਲੱਗਦੀ ਇਸ ਕਰਕੇ ਸਾਨੂੰ ਦੌੜਨ ਦਾ ਬਹੁਤ ਸੌਂਕ ਹੈ ਅਸੀਂ ਅੱਜ ਕੱਲ੍ਹ ਵੀ ਦੌੜ ਦੌੜਨ ਜਾਈ ਦਾ ਹੈ ਸਵੇਰੇ ਸ਼ਾਮ ਦੌੜ ਲਗਾ ਕੇ ਆਪਣੇ ਘਰ ਆਈ ਦਾ ਹੈ ਬਸ ਜੀ